ਪੰਜਾਬੀ ਲੋਕ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਅਤੇ ਸਨਮਾਨ ਦੇਣ ਦੇ ਲਈ ਆਪਣੀ ਭਾਸ਼ਾ ਦੀ ਅਲੱਗ ਅਲੱਗ ਤਰੀਕੇ ਨਾਲ਼ ਵਰਤੋਂ ਕਰਦੇ ਨੇ ਜਿਵੇਂ ਵਾਰਾਂ ਗਾਈ ਜਾਂਦੀਆਂ ਨੇ ਜਿਵੇਂ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਨਾਲ਼ ਰਿਲੇਟਿਡ ਹੈ ਉਹਨਾਂ ਨੇ ਇਸਦੇ ਵਿੱਚ ਕਿਹਾ ਸੀਗਾ ਵੀ ਮਤਲਬ ਜਿਹੜਾ ਰੱਬ ਨੂੰ ਮੰਨਣਾ ਹੀ ਮੇਰਾ ਜੀਵਨ ਹੈਗਾ ਤਾਂ ਜਿਵੇਂ ਕਵਿਤਾਵਾਂ ਬੋਲੀਆਂ ਜਾਂਦੀਆਂ ਨੇ ਸਕੂਲਾਂ ਦੇ ਵਿੱਚ ਛੋਟੀ ਛੋਟੀਆਂ ਬੱਚੀਆਂ ਨੂੰ ਸ਼ੁਰੂ ਤੋਂ ਹੀ ਗਿੱਧੇ ਦੇ ਨਾਲ਼ ਜੋੜਿਆ ਜਾਂਦਾ ਗਾ ਗਿੱਧਾ ਉਹ ਪਾਉਂਦੀਆਂ ਨੇ ਬੋਲੀਆਂ ਮਤਲਬ ਜਿਹੜੀਆਂ ਸੱਭਿਆਚਾਰ ਨਾਲ਼ ਰਿਲੇਟਿਡ ਨੇ ਉਹ ਉੱਥੇ ਬੋਲੀਆਂ ਜਾਂਦੀਆਂ ਨੇ ਸੱਭਿਆਚਾਰਕ ਗੀਤ ਗਾਏ ਜਾਂਦੇ ਹੈਗੇ ਸਲਾਨਾ ਕੋਈ ਪ੍ਰੋਗਰਾਮ ਹੁੰਦੇ ਹੈਗੇ ਮਿਰਜ਼ੇ ਦਾ ਗਾਇਨ ਕੀਤਾ ਜਾਂਦਾ ਗਾ ਸਕੂਲਾਂ ਦੇ ਵਿੱਚ ਭਾਸ਼ਾ ਦੇ ਜਿਹੜਾ ਮਸਲੇ ਦੇ ਉੱਪਰ ਸਪੀਚਾਂ ਹੁੰਦੀਆਂ ਨੇ ਜਿਹੜੇ ਸਟੂਡੈਂਟ ਨੇ ਉਹ ਅਲੱਗ ਅਲੱਗ ਆਪਦੇ ਵਿਚਾਰ ਪੇਸ਼ ਕਰਦੇ ਹੈਗੇ ਮਤਲਬ ਭਾਸ਼ਾ ਨੂੰ ਸਨਮਾਨ ਦੇਣ ਦੇ ਲਈ ਜਿਹੜੇ ਪੰਜਾਬੀ ਲੋਕ ਨੇ ਲਗਾਤਾਰ ਉਹ ਕੁਛ ਨਾ ਕੁਛ ਕਰਦੇ ਰਹਿੰਦੇ ਹੈਗੇ ਕਿਸੇ ਨਾ ਕਿਸੇ ਤਰੀਕੇ ਨਾਲ਼ ਆਪਦੀ ਭਾਸ਼ਾ ਨੂੰ ਬਚਾਉਣ ਦੇ ਲਈ ਆਪਦੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਉਹ ਅਲੱਗ ਅਲੱਗ ਸਮੇਂ 'ਤੇ ਅਲੱਗ ਅਲੱਗ ਤਰੀਕੇ ਨਾਲ਼ ਕੋਈ ਨਾ ਕੋਈ ਸੱਭਿਆਚਾਰਕ ਪ੍ਰੋਗਰਾਮ ਕਰਦੇ ਹੈਗੇ ਉੱਥੇ ਗ ਕਵਿਤਾਵਾਂ ਗੀਤ ਗਿੱਧਾ ਬੋਲੀਆਂ ਅਲੱਗ ਅਲੱਗ ਜਿਹੜੇ ਉਹ ਵੰਨਗੀਆਂ ਪੇਸ਼ ਕਰਦੇ ਨੇ